ਭਾਰਤ ਵਿੱਚ ਬਹੁਤ ਸਾਰੇ ਮਸ਼ਹੂਰ ਨਾਚ ਹਨ ਜਿਨ੍ਹਾਂ ਵਿੱਚੋਂ ਗਿੱਧਾ ਭੰਗੜਾ ਲੁੰਡੀ ਸੰਮੀ ਡਾਂਡੀਆਂ ਪੀਹੂ ਆਦਿ ਡਾਂਸ ਭਾਰਤ ਵਿੱਚ ਪਾਏ ਜਾਂਦੇ ਹਨ ਸਭ ਤੋਂ ਜ਼ਿਆਦਾ ਮਸ਼ਹੂਰ ਗਿੱਧਾ ਅਤੇ ਭੰਗੜਾ ਪਾਏ ਜਾਂਦੇ ਹਨ ਗਿੱਧਾ ਆਮ ਤੌਰ 'ਤੇ ਔਰਤਾਂ ਪਾਉਂਦੀਆਂ ਹਨ ਭੰਗੜਾ ਮਰਦ ਪਾਉਂਦੇ ਹਨ ਭੰਗੜਾ ਢੋਲ ਦੇ ਉੱਤੇ ਪਾਇਆ ਜਾਂਦਾ ਹੈ ਅਤੇ ਭੰਗੜਾ ਡੀ ਜੇ 'ਤੇ ਵੀ ਪਾਇਆ ਜਾਂਦਾ ਹੈ ਗਿੱਧਾ ਆਮ ਤੌਰ 'ਤੇ ਹਰ ਇੱਕ ਖੁਸ਼ੀ ਦੇ ਵਿੱਚ ਔਰਤਾਂ ਪਾਉਂਦੀਆਂ ਹਨ ਜਿੱਦਾਂ ਬੱਚੇ ਦੇ ਜੰਮਣ 'ਤੇ ਖੁਸ਼ੀ ਮਨਾਉਂਦੇ ਹਨ ਉਸ ਵਿੱਚ ਗਿੱਧਾ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਭੰਗੜਾ ਪਾਇਆ ਜਾਂਦਾ ਹੈ ਡੀ ਜੇ ਦੇ ਉੱਤੇ